ਮੇਰੇ ਖਿਆਲ ਵਿੱਚ ਪੰਜਾਬੀ ਭਾਸ਼ਾ ਪੂਰੇ ਭਾਰਤ ਵਿੱਚ ਬੜੀ ਅਹਿਮ ਭੂਮਿਕਾ ਨਿਭਾਦੀ ਨਿਭਾਉਂਦੀ ਹੈ ਅਸੀਂ ਵੇਖਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਵੀ ਅਸੀਂ ਕਦੋਂ ਕਿਸੇ ਵਿਆਹ ਸ਼ਾਦੀ 'ਤੇ ਜਾਂਦੇ ਹਾਂ ਤਾਂ ਗੋਨ ਗਾਏ ਜਾਂਦੇ ਨੇ ਗਿੱਧੇ ਪਾਏ ਜਾਂਦੇ ਨੇ ਭੰਗੜਾ ਕੀਤਾ ਜਾਂਦਾ ਹੈ ਪੰਜਾਬੀ ਗਾਣਿਆਂ ਉੱਤੇ ਹੀ ਇਹ ਸਭ ਕੁਛ ਕੀਤਾ ਜਾਂਦਾ ਹੈ ਅਤੇ ਪੰਜਾਬੀ ਭਾਸ਼ਾ ਇੱਕ ਐਸੀ ਭਾਸ਼ਾ ਹੈਗੀ ਹੈ ਜਿਸ 'ਤੇ ਮਤਲਬ ਕਿ ਕੋਈ ਗਾਣਾ ਲੱਗਾ ਹੋਵੇ ਹਰ ਭਾਸ਼ਾ ਦਾ ਬੰਦਾ ਉਸ 'ਤੇ ਨੱਚਣਾ ਨੱਚਦਾ ਅਸੀਂ ਕਿਧਰੇ ਕਿਧਰੇ ਮੈਰਿਜ 'ਤੇ ਜਾਂਦੇ ਹਾਂ ਬਾਹਰ ਕਿਧਰੇ ਆਪਣੇ ਦੂਸਰੀ ਜਗ੍ਹਾ 'ਤੇ ਅਸੀਂ ਉੱਥੇ ਵੀ ਆਪਣੀ ਭਾਸ਼ਾ ਦੇ ਕੋਈ ਦੂਸਰੀ ਭਾਸ਼ਾ ਦਾ ਗਾਣਾ ਚੱਲ ਰਿਹਾ ਤਾਂ ਆਪਣੀ ਪੰਜਾਬੀ ਭਾਸ਼ਾ ਦੇ ਹਿਸਾਬ ਨਾਲ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਪੰਜਾਬੀ ਡ ਭਾਸ਼ਾ ਇੱਕ ਐਸੀ ਭਾਸ਼ਾ ਇਹਦੇ ਵਿੱਚ ਕੋਈ ਵੀ ਗਾਣਾ ਲੱਗਾ ਹੋਵੇ ਹਰ ਬੰਦਾ ਇਹਦੇ 'ਚ ਨੱਚਣ 'ਚ ਬੜਾ ਕੰਫਰਟੇਬਲ ਲੈਂਦਾ ਹੈ ਪੰਜਾਬੀ ਭਾਸ਼ਾ ਦੇ ਵਿੱਚ ਅਗਰ ਅਸੀਂ ਹੋਰ ਵੀ ਦਿੱਲੀ ਚਲ ਜਾਈਏ ਅਸੀਂ ਹੋਰ ਫਰੀਦਾਬਾਦ ਮੈਂ ਘੁੰਮਿਆ ਹੈ ਦਿੱਲੀ ਘੁੰਮਿਆ ਹੈ ਨੋਇਡਾ ਘੁੰਮਿਆ ਉੱਥੇ ਵੀ ਮੈਂ ਦੇਖਿਆ ਕਈ ਲੋਕ ਗਏ ਜਿਹਦੇ ਕਿ ਪੰਜਾਬੀ ਵਸੇ ਹੋਏ ਨੇ ਔਰ ਉਹ ਪੰਜਾਬੀ ਆਪਸ ਘਰ ਦੇ ਵਿੱਚ ਬੋਲਦੇ ਨੇ ਔਰ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਸਿਖਾਉਂਦੇ ਨੇ ਪੰਜਾਬੀ ਕਾਫ਼ੀ ਬੜੀ ਵਧੀਆ ਭਾਸ਼ਾ ਔਰ ਕਾਫ਼ੀ ਜਗ੍ਹਾ 'ਤੇ ਬੋਲੀ ਜਾਂਦੀ ਹੈ